ਸਾਡੇ ਪੇਂਡੂ ਭਾਈਚਾਰੇ ਵਿੱਚ ਕਰਿਆਨਾ ਸਟੋਰ ਅਤੇ ਸ਼ੂਜ਼ ਸਟੋਰ ਦਾ ਕਾਰੋਬਾਰ ਸ਼ੁਰੂ ਹੋਇਆ ਸੀ ਅਤੇ ਇਹ ਕਾਰੋਬਾਰ ਬਹੁਤ ਹੀ ਜ਼ਿਆਦਾ ਸਫਲ ਹੋਇਆ ਸੀ ਇਸ ਕਾਰੋਬਾਰ ਨੂੰ ਸਫਲ ਬਣਾਉਣ ਲਈ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਪਈ ਸੀ ਅਤੇ ਜਿਵੇਂ ਜਿਵੇਂ ਇੰਟਰਨੈਟ ਆਇਆ ਸੀ ਤਾਂ ਉਸਨੇ ਇਸ ਦੀ ਸਫਲਤਾ ਨੂੰ ਹੋਰ ਵੀ ਵਧਾ ਦਿੱਤਾ ਸੀ ਇੰਟਰਨੈਟ ਰਾਹੀਂ ਇਸ ਦੁਕਾਨ ਦੇ ਸਮਾਨ ਨੂੰ ਅਸੀਂ ਪਾ ਦਿੰਦੇ ਸੀ ਸ਼ੋਪਸ 'ਤੇ ਐਪਸ 'ਤੇ ਫਿਰ ਉਸ ਐਪ ਰਾਹੀਂ ਸਮਾਨ ਦਾ ਜੋ ਆਰਡਰ ਆਉਂਦਾ ਸੀ ਉਸ ਨੂੰ ਡਿਲੀਵਰ ਕੀਤਾ ਜਾਂਦਾ ਸੀ ਇਸ ਤਰ੍ਹਾਂ ਇਹ ਕਾਰੋਬਾਰ ਬਹੁਤ ਹੀ ਜ਼ਿਆਦਾ ਸਫਲ ਹੋਇਆ ਸੀ